ਮੈਂ ਤੁਹਾਨੂੰ ਆਪਣੇ ਸਫਰ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ ਮੈਂ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਪਲੱਸ ਟੂ ਜਮਾਤ ਵਿੱਚ ਕੀਤਾ ਸੀ ਅਤੇ ਇਸ ਵਿੱਚ ਪੂਰੇ ਪੰਜਾਬ ਦੇ ਹਰ ਵੱਖ ਵੱਖ ਸਕੂਲ ਦੇ ਵਿਦਿਆਰਥੀ ਵੀ ਗਏ ਸਨ ਇਹ ਜਿਹੜਾ ਸਫਰ ਸੀ ਉਹ ਪੰਜਾਬ ਸਰਕਾਰ ਵੱਲੋਂ ਦੁਆਰਾ ਪ੍ਰਸਤੁਤ ਕੀਤਾ ਗਿਆ ਸੀ ਅਤੇ ਇਸ ਦੇ ਵਿੱਚ ਸਾਨੂੰ ਗਿਆਰ੍ਹਾਂ ਦਿਨਾਂ ਦਾ ਜਿਹੜਾ ਸੀ ਟੂਰ ਲੈ ਕੇ ਗਏ ਸੀ ਸਾਨੂੰ ਉੱਥੇ ਜਾ ਕੇ ਇੰਨਾਂ ਵਧੀਆ ਲੱਗਿਆ ਇੰਨਾਂ ਮਜ਼ਾ ਆਇਆ ਸਾਨੂੰ ਉੱਥੇ ਵੱਖ ਵੱਖ ਤਰ੍ਹਾਂ ਦੇ ਗੇਮਸ ਕਰਾਏ ਐਕਟੀਵਿਟੀਜ ਕਰਾਈਆਂ ਬਹੁਤ ਹੀ ਜ਼ਿਆਦਾ ਵਧੀਆ ਸੀ ਉਹ ਸਾਰਾ ਕੁਛ ਸਾਨੂੰ ਸੁਬਹਾ ਸੁਬਹਾ ਪੀਟੀ ਵਾਸਤੇ ਪਹਾੜਾਂ 'ਚ ਲੈ ਕੇ ਜਾਂਦੇ ਸੀ ਸੁਬਹਾ ਸਾਨੂੰ ਚਾਰ ਵਜੇ ਉਠਾਇਆ ਜਾਂਦਾ ਸੀ ਪੀਟੀ ਲਈ ਸਾਨੂੰ ਉੱਥੇ ਜਾ ਕੇ ਵੱਖ ਵੱਖ ਤਰ੍ਹਾਂ ਦੀਆਂ ਪਹਾੜ ਦੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਉਹ ਦੱਸੀਆਂ ਗਈਆਂ ਉਹਨਾਂ ਬਾਰੇ ਸਾਨੂੰ ਦੱਸਿਆ ਗਿਆ ਅਤੇ ਸਾਨੂੰ ਹਰ ਰੋਜ਼ ਕਿਤੇ ਦੂਰ ਟਰੈਕਿੰਗ 'ਤੇ ਲੈ ਕੇ ਜਾਇਆ ਜਾਂਦਾ ਸੀ ਮੇਰੇ ਨਾਲ ਦੀਆਂ ਸਹੇਲੀਆਂ ਦੇ ਜੋ ਕਿ ਬਰਨਾਲੇ ਤੋਂ ਆਈਆਂ ਸਨ ਉਹਨਾਂ ਨੇ ਪਹਿਲੀ ਵਾਰ ਇਹ ਸਭ ਕੁਛ ਕੀਤਾ ਸੀ ਅਤੇ ਇਹ ਮੇਰੇ ਲਈ ਵੀ ਪਹਿਲੀ ਵਾਰ ਹੀ ਸੀ ਮੇਰੀਆਂ ਸਹੇਲੀਆਂ ਅਤੇ ਮੈਂ ਅਸੀਂ ਖੇਡਣ ਵਿੱਚ ਵੀ ਅੱਗੇ ਸ ਹਨ ਪਰ ਉਹ ਪੜ੍ਹਾਈ ਵਿੱਚ ਸੀ ਉਹਨਾਂ ਨੇ ਇਹ ਸਭ ਕੁਛ ਪਹਿਲੀ ਵਾਰ ਕੀਤਾ ਜਿਸ ਨਾਲ ਉਹਨਾਂ ਦੇ ਪੈਰਾਂ 'ਚ ਖੱਲੀਆਂ ਪੈ ਗਈਆਂ ਅਤੇ ਉਹਨਾਂ ਤੋਂ ਜਮਾਂ ਵੀ ਤੁਰਿਆ ਨਾ ਜਾਵੇ ਅਤੇ ਮੈਂ ਉਹਨਾਂ ਨੂੰ ਦੱਸਿਆ ਵੀ ਇਹਨਾਂ ਖੱਲੀਆਂ ਨੂੰ ਕਿਸ ਤਰ੍ਹਾਂ ਕੱਢਣਾ ਆ ਉਹ ਕਿਸ ਤਰ੍ਹਾਂ ਚੱਲ ਸਕਦੇ ਹਨ ਉਹਨਾਂ ਨੂੰ ਹਿੰਮਤ ਦਿੱਤੀ ਰੋਜ਼ ਰੋਜ਼ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਆਹਾ ਕਸਰਤ ਕਰਨ ਜਿਸ ਨਾਲ ਉਹਨਾਂ ਨੂੰ ਵਧੀਆ ਮਹਿਸੂਸ ਹੋਵੇ ਉਹਨਾਂ ਨੂੰ ਚਲਣ ਫਿਰਨ ਘੁੰਮਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਉਹ ਇੱਕ ਇਸ ਸਫਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇੰਜੋਏ ਕਰ ਸਕਣ ਤਾਂ ਕਿ ਇਹ ਜੋ ਸਫਰ ਹੈ ਇਹ ਹਮੇਸ਼ਾ ਲਈ ਯਾਦਗਾਰ ਰਵੇ ਇਸ ਨੂੰ ਕਦੇ ਭੁੱਲਿਆ ਨਾ ਜਾ ਸਕੇ ਅਤੇ ਇਸ ਨੂੰ ਅੱਜ ਵੀ ਮੈਂ ਤਾਂ ਕਦੇ ਵੀ ਨਹੀਂ ਭੁੱਲ ਸਕਦੀ ਇਹ ਸਫਰ ਮੇਰਾ ਮਨ ਪਸੰਦੀਦਾ ਸਫਰ ਸੀ ਜਿਸ ਨਾਲ ਮੈਂ ਆਪਣੇ ਦੋਸਤਾਂ ਨਾਲ ਗਈ ਸਾਂ